ਪਿਛਲੇ ਹਫਤੇ ਨਾ ਮੈਂ ਨਾਢਾ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਇਆ ਅਤੇ ਮੈਂ ਸੋਚ ਰਹੀ ਸੀ ਵੀ ਨਾਢਾ ਸਾਹਿਬ ਕਿਵੇਂ ਜਾਇਆ ਜਾਵੇ ਮੈਂ ਫਿਰ ਸਰਹੰਦ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੀ ਬੱਸ ਲਈ ਫੋਟੀ ਥ੍ਰੀ ਦੇ ਬੱਸ ਸਟੈਂਡ ਦੀ ਫੋਟੀ ਥ੍ਰੀ ਦੀ ਬੱਸ ਮੈਨੂੰ ਮਿਲ ਗਈ ਉਸ ਤੋਂ ਬਾਅਦ ਫਿਰ ਮੈਂ ਉਬਰ ਦੀ ਕੈਬ ਬੁੱਕ ਕਰ ਲਈ ਪਹਿਲਾਂ ਮੈਨੂੰ ਮੈਂ ਕਦੇ ਉਬਰ ਦੀ ਕੈਬ 'ਤੇ ਕਦੇ ਗਈ ਨਹੀਂ ਸੀਗੀ ਮੈਨੂੰ ਡਰ ਵੀ ਲੱਗ ਰਿਹਾ ਸੀ ਵੀ ਮੈਂ ਮੇਰਾ ਐਕਸਪੀਰੀਅੰਸ ਕਿਵੇਂ ਦਾ ਹੋਊਗਾ ਜੇ ਉਬਰ ਕੈਬ ਮੈਂ ਯੂਸ ਕਰੂੰਗੀ ਹੈ ਨਾ ਬਟ ਚੱਲੋ ਮੈਂ ਰੱਬ ਦਾ ਨਾਂ ਲੈ ਕੇ ਉਬਰ ਕੈਬ ਆਪਣੀ ਬੁੱਕ ਕਰ ਲਈ ਅਤੇ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਉਬਰ ਕੈਬ ਜਿਹੜੀ ਸੀਗੀ ਉੱਥੇ ਅਵੇਲੇਬਲ ਸੀਗੀ ਖੜ੍ਹੀ ਸੀਗੀ ਅਤੇ ਮੈਂ ਨਾਲ ਦੀ ਨਾਲ ਕੈਬ ਦੇ ਵਿੱਚ ਬੈਠੀ ਅਤੇ ਮੈਂ ਡਰਾਈਵਰ ਨੂੰ ਕਹਿ ਤਾ ਕਿ ਮੈਨੂੰ ਨਾਢਾ ਸਾਹਿਬ ਉਤਾਰ ਦਿਉ ਹੈ ਨਾ ਅਤੇ ਮੈਨੂੰ ਬੜਾ ਥੋੜ੍ਹਾ ਅਜੀਬ ਵੀ ਲੱਗਿਆ ਵੀ ਪਹਿਲੀ ਵਾਰੀ ਮੈਂ ਕੱਲੀ ਇਸ ਤਰਾਂ ਉਬਰ ਕੈਬ ਦੇ ਵਿੱਚ ਨਾਢਾ ਸਾਹਿਬ ਜਾ ਰਹੀ ਹਾਂ ਬਟ ਡਰਾਈਵਰ ਨੇ ਜਦੋਂ ਚੱਲੋ ਚਲਾਣੀ ਸਟਾਰਟ ਕਰਤੀ ਹੈ ਨਾ ਬੜੀ ਮਤਲਬ ਪਰ ਮੈਨੂੰ ਵਧੀਆ ਲੱਗਿਆ ਸਾਰਾ ਡਰਾਈਵਰ ਦਾ ਜਿਹੜਾ ਬਿਹੇਵੀਅਰ ਸੀਗਾ ਵਿਹਾਰ ਸੀਗਾ ਉਹ ਬਹੁਤ ਵਧੀਆ ਸੀਗਾ ਡਰਾਈਵਰ ਨੇ ਬਹੁਤ ਪੂਰੀ ਸਪੀਡ ਮਤਲਬ ਬਹੁਤ ਘੱਟ ਰੱਖੀ ਬਹੁਤ ਬਿਲਕੁਲ ਆਰਾਮ ਨਾਲ ਮੈਨੂੰ ਫੀਲ ਹੀ ਨਹੀਂ ਹੋਇਆ ਮੈਂ ਕਾਰ 'ਚ ਬੈਠ ਕੇ ਜਾ ਰਹੀ ਹਾਂ ਆਰਾਮ ਦੇ ਨਾਲ ਮੈਂ ਆਪਣਾ ਨਾਢਾ ਸਾਹਿਬ ਗਈ ਹਾਂ ਅਤੇ ਉਹਨਾਂ ਨੇ ਮਤਲਬ ਪੂਰੇ ਟਾਈਮ ਦੇ ਵਿੱਚ ਜਿੱਥੇ ਵੀ ਲਾਈਟ ਸੀਗੀਆਂ ਰਸਤੇ ਦੇ ਵਿੱਚ ਜਾ ਜਿੱਥੇ ਵੀ ਰੁਕਣਾ ਬਣਦਾ ਸੀਗਾ ਡਰਾਈਵਰ ਨੇ ਗੱਡੀ ਆਰਾਮ ਨਾਲ ਰੋਕੀ ਹੈ ਅਤੇ ਆਰਾਮ ਨਾਲ ਬਿਲਕੁਲ ਮਤਲਬ ਘੱਟ ਸਪੀਡ 'ਤੇ ਉਹ ਮੈਨੂੰ ਲੈ ਕੇ ਗਿਆ ਅਤੇ ਮੈਨੂੰ ਬਿਲਕੁਲ ਟਾਈਮ 'ਤੇ ਪਹੁੰਚਾ ਤਾ ਅਤੇ ਫਿਰ ਮੈਂ ਮੈਨੂੰ ਲੱਗਿਆ ਕਿ ਮੈਨੂੰ ਵਾਪਸ ਵੀ ਇਹੀ ਕੈਬ ਬੁੱਕ ਕਰ ਲੈਣੀ ਚਾਹੀਦੀ ਹੈ ਫਿਰ ਮੈਂ ਸਗੋਂ ਡਰਾਈਵਰ ਨੂੰ ਕਿਹਾ ਕਿ ਤੁਸੀਂ ਇੱਥੇ ਹੀ ਮੇਰਾ ਵੇਟ ਕਰ ਲਉ ਮੈਨੂੰ ਅੱਧਾ ਪੌਣਾ ਘੰਟਾ ਲੱਗੂਗਾ ਗੁਰਦੁਆਰਾ ਸਾਹਿਬ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਮੈਨੂੰ ਨਾਲ ਦੀ ਨਾਲ ਵਾ ਵਾਪਸ ਫੋਟੀ ਥ੍ਰੀ ਛੱਡ ਦਿਓ ਅਤੇ ਫਿਰ ਉਹਨੇ ਉਹ ਮੰਨ ਗਿਆ ਕਿ ਠੀਕ ਹੈ ਮੈਂ ਤੁਹਾਨੂੰ ਵਾਪਸ ਛੱਡ ਦੇਵਾਂਗਾ ਬਟ ਤੁਸੀਂ ਔਨਲਾਈਨ ਬੁਕਿੰਗ ਕਰ ਦਿਉ ਫਿਰ ਮੈਂ ਔਨਲਾਈਨ ਬੁਕਿੰਗ ਕਰਤੀ ਅਤੇ ਉਹਨਾਂ ਨੇ ਮੈਨੂੰ ਵਾਪਸ ਉਥੇ ਫੋਟੀ ਥ੍ਰੀ ਦੇ ਬੱਸ ਸਟੈਂਡ ਜਿਹੜਾ ਹੈਗਾ ਵਾਪਸ ਛੱਡਿਆ ਰਸਤੇ 'ਚ ਮੈਨੂੰ ਪਾਣੀ ਵਗੈਰਾ ਚਾਹੀਦਾ ਸੀ ਉਹਨਾਂ ਨੇ ਮੈਨੂੰ ਖੁਦ ਹੀ ਪਾਣੀ ਵੀ ਲਿਆ ਕੇ ਦਿੱਤਾ ਅਤੇ ਮੈਨੂੰ ਬਹੁਤ ਅੱਛਾ ਮਤਲਬ ਵਿਹਾਰ ਲੱਗਿਆ ਡਰਾਈਵਰ ਦਾ ਕਿ ਫਿਰ ਮੈਂ ਜਦੋਂ ਫੋਟੀ ਥ੍ਰੀ ਦੇ ਬੱਸ ਸਟੈਂਡ ਉਹਨਾਂ ਨੇ ਮੈਨੂੰ ਉਤਾਰਿਆ ਤਾਂ ਮੈਂ ਡਰਾਈਵਰ ਦਾ ਬਹੁਤ ਬਹੁਤ ਧੰਨਵਾਦ ਕੀਤਾ ਕਿ ਇਸ ਤਰ੍ਹਾਂ ਜੇ ਹਰ ਬੰਦਾ ਆਪਣੀ ਜਿਹੜੀ ਜੋਬ ਹੈ ਵਧੀਆ ਤਰੀਕੇ ਨਾਲ ਕਰੇ ਤਾਂ ਆਪਣਾ ਜਿਹੜਾ ਦੇਸ਼ ਹੈ ਉਹ ਸਕਸੈਸਫੁੱਲ ਹੋ ਸਕਦਾ ਹੈ